ਮੇਰੇ ਲਈ ਚਿੱਤਰਕਾਰੀ ਦਾ ਸਭ ਤੋਂ ਚੁਣੌਤੀਪੂਰਨ ਕੰਮ ਮੈਂ ਡਰਾਇੰਗ ਲਈ ਇਸਤੇਮਾਲ ਕਰਨ ਵਾਲੇ ਪੇਜਾਂ ਅਤੇ ਰੰਗਾਂ ਦੀ ਸਮੱਸਿਆ ਹੈ ਮੈਨੂੰ ਪੇਜ ਅਤੇ ਰੰਗ ਆਪਣੀ ਮਰਜ਼ੀ ਦੇ ਅਨੁਸਾਰ ਨਹੀਂ ਮਿਲਦੇ ਇਸ ਲਈ ਮੈਨੂੰ ਦੂਰ ਜਾਣਾ ਪੈਂਦਾ ਹੈ ਮੈਂ ਆਪਣੇ ਰੰਗਾਂ ਅਤੇ ਪੇਜਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੱਖ ਵੱਖ ਇਲਾਕਿਆਂ ਤੋਂ ਆਪਣੇ ਚਿੱਤਰਕਾਰੀ ਦਾ ਸਮਾਨ ਲੈਣ ਜਾਂਦੀ ਹਾਂ ਮੈਨੂੰ ਕਿਸੇ ਬਿਲਡਿੰਗ ਦੀਆਂ ਤਸਵੀਰਾਂ ਬਣਾਉਣੀਆ ਔਖੀਆਂ ਲੱਗਦੀਆਂ ਹਨ ਮੈਨੂੰ ਨਾ ਤਾਂ ਦਰਵਾਜ਼ੇ ਬਣਾਉਣੇ ਔਖੇ ਲੱਗਦੇ ਹਨ ਮੈਂ ਉਹ ਚੀਜ਼ ਦਾ ਅਭਿਆਸ ਕਰਨ ਲਈ ਆਪਣੇ ਅਧਿਆਪਕਾਂ ਆਪਣੇ ਦੋਸਤਾਂ ਅਤੇ ਇੰਟਰਨੈਟ ਸੇਵਾਵਾਂ ਦੀ ਵਰਤੋਂ ਕਰਦੀ ਹਾਂ ਜਿਨ੍ਹਾਂ ਨੂੰ ਜਿੰਨਾ ਕੁਛ ਪਤਾ ਹੁੰਦਾ ਹੈ ਉਹਨਾਂ ਕੋਲ ਉਸ ਅਨੁਸਾਰ ਜਾਣਕਾਰੀ ਲੈ ਲੈਂਦੀ ਹਾਂ ਅਤੇ ਮੈਂ ਆਪਣਾ ਅਭਿਆਸ ਜਾਰੀ ਰੱਖਦੀ ਹਾਂ